ਪਟਿਆਲੇ ਦੇ ਵਿੱਚ ਜਿਹੜੇ ਕਾਰਖਾਨੇ ਹੈ ਚੌਲ ਕਾਰਖਾਨਾ ਬਿਜਲੀ ਦਾ ਕਾਰਖਾਨਾ ਦਵਾਈਆਂ ਦਾ ਕਾਰਖਾਨਾ ਇੰਜਨੀਅਰਿੰਗ ਜਿਹੜੀ ਇੰਡਸਟਰੀ ਹੋ ਗਈ ਅਤੇ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਸੰਦ ਬਣਦੇ ਆ ਉਹ ਕਾਰਖਾਨਾ ਹੋ ਗਿਆ ਇਹ ਜਿਹੜੇ ਇੱਥੋਂ ਦੇ ਕਾਰਖਾਨੇ ਆ ਇਹ ਕਾਰਖਾਨੇ ਆ ਜਿਹੜੇ ਇਹ ਗਰੀਨ ਰੈਵੂਲੇਸ਼ਨ ਤੋਂ ਬਾਅਦ ਜਿਹੜੇ ਸ਼ੁਰੂ ਹੋਏ ਹੈ ਗਰੀਨ ਰੈਵੂਲੇਸ਼ਨ ਦੇ ਨਾਲ ਜਿਹੜੇ ਖੇਤੀ ਦੇ ਵਿੱਚ ਨਵੀਆਂ ਨਵੀਆਂ ਤਕਨੀਕਾਂ ਦੇ ਨਾਲ ਜਿਹੜੀ ਖੇਤੀ ਹੋਣ ਲੱਗ ਗਈ ਸੀ ਫਸਲਾਂ 'ਚ ਵਾਧਾ ਹੋਣ ਲੱਗ ਗਿਆ ਸੀ ਫਸਲਾਂ ਜਿਹੜੀਆਂ ਬਦਲ ਬਦਲ ਕੇ ਬੀਜੀਆਂ ਜਾਣ ਲੱਗ ਗਈਆਂ ਸੀਗੀਆਂ ਅਤੇ ਜਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਆਈਆਂ ਉਹ ਪ੍ਰੋਬਲਮਸ ਕੀ ਹੈ ਜਿਹੜੀ ਮੇਨ ਪ੍ਰੋਬਲਮ ਆਈ ਹੈ ਕੋਵਿਡ ਤੋਂ ਬਾਅਦ ਕੋਵਿਡ ਤੋਂ ਬਾਅਦ ਜਿਹੜੀ ਇਹ ਇੰਡਸਟਰੀ ਹੈ ਇਹ ਲੰਬੇ ਸਮੇਂ ਲਈ ਜਿਹੜੀ ਬੰਦ ਰਹੀ ਹੈ ਜਿਹਦੇ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਸ ਸੈਕਿੰਡ ਆ ਗਿਆ ਇਹਨਾਂ ਨੂੰ ਸਕਿੱਲਡ ਲੇਵਰ ਨਹੀਂ ਮਿਲ ਰਹੀ ਫਿਰ ਇਹਨਾਂ ਨੂੰ ਬਿਜਲੀ ਘੱਟ ਮਿਲਦੀ ਹੈ ਕਦੇ ਕਦੇ ਇਹਨਾਂ ਨੂੰ ਕੱਚਾ ਮਾਲ ਹੈ ਜਿਹੜਾ ਉਹ ਵੀ ਪ੍ਰੋਪਰ ਟਾਈਮ 'ਤੇ ਨਹੀਂ ਪਹੁੰਚਦਾ ਉਹਦੇ ਕਰਕੇ ਵੀ ਜਿਹੜਾ ਇਹ ਇੰਡਸਟਰੀ ਨੂੰ ਕਾਫੀ ਜਿਹੜਾ ਨੁਕਸਾਨ ਹੋਇਆ